ਹੈਲੋ ਸਰ ਅਸੀਂ ਓਲਾ ਕੰਪਨੀ ਕੈਬ ਦੀ ਕੈਬ ਬੁੱਕ ਕਰਵਾਈ ਹੈਗੀ ਆ ਕਿਉਂਕਿ ਅਸੀਂ ਪਿੰਡ ਠਣ ਤੋਂ ਬੋਲਦੇ ਹਾਂ ਅਸੀਂ ਦਰਸ਼ਨਾਂ ਲਈ ਜਾਣਾ ਸੀ ਜਗਤਪੁਰਾ ਤੋਂ ਤਰਨ ਤਾਰਨ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਪਰ ਕੈਬ ਸਾਡੇ ਤੋਂ ਤੱਕ ਅਜੇ ਤੱਕ ਨਹੀਂ ਪਹੁੰਚੀ ਹੈਗੀ ਜਿਸ ਲਈ ਸਾਨੂੰ ਬਹੁਤ ਪਰੇਸ਼ਾਨੀ ਹੋ ਰਹੀ ਆ ਕਿਉਂਕਿ ਅਸੀਂ ਬਹੁਤ ਜ਼ਿਆਦਾ ਲੇਟ ਹੁੰਦੇ ਜਾ ਰਹੇ ਹਨ ਸਾਨੂੰ ਨੌਂ ਨੌਂ ਵਜੇ ਕੈਬ ਚਾਹੀਦੀ ਸੀ ਅਸੀਂ ਨੌਂ ਵਜੇ ਦਾ ਟਾਈਮ ਦਿੱਤਾ ਹੋਇਆ ਸੀ ਪਰ ਸਾਡੇ ਕੋਲ ਅਜੇ ਤੱਕ ਨਹੀਂ ਕੈਬ ਪਹੁੰਚੀ ਪਲੀਜ਼ ਤੁਸੀਂ ਸਾਨੂੰ ਜੇ ਤੁਹਾਨੂੰ ਐਡਰੈਸ ਨਹੀਂ ਪਤਾ ਚੱਲ ਰਿਹਾ ਤੁਸੀਂ ਇਸ ਐਡਰਸ ਦੱਸਦੇ ਹੈਗੇ ਹਾਂ ਇੱਥੇ ਬਹੁਤ ਵੱਡੀ ਸਾਰੀ ਬਿਲਡਿੰਗ ਹੈਗੀ ਆ ਜਿੱਥੇ ਅਸੀਂ ਖੜ੍ਹੇ ਹਾਂ ਮੇਨ ਬਾਜ਼ਾਰ ਦੇ ਵਿੱਚ ਹੀ ਲਾਗੇ ਕਰਿਆਨੇ ਦੀ ਦੁਕਾਨ ਆ ਨੀਅਰ ਗੁਰਦੁਆਰਾ ਸਾਹਿਬ ਵੀ ਹੈ ਤੁਸੀਂ ਛੇਹਰਟਾ ਸਾਹਿਬ ਤੋਂ ਜਦੋਂ ਆਉਣਾ ਹੈ ਇੱਧਰ ਦੀ ਸਿ ਸਿੱਧੇ ਨਾ ਸਿੱਧੇ ਰੋਡ ਥਾਈਂ ਆ ਕੇ ਸਾਨੂੰ ਪਿੱਕ ਕਰ ਸਕਦੇ ਜੇ ਏ ਜਲਦੀ ਤੋਂ ਜਲਦੀ ਨਾ ਆਓ ਪਰ ਹੁਣ ਨੌਂ ਵਜੇ ਤੋਂ ਟਾਈਮ ਸਾਢੇ ਨੌਂ ਦਾ ਹੋ ਚੁੱਕਾ ਇੰਨਾ ਪਰ ਤੁਸੀਂ ਅਜੇ ਤੱਕ ਨਹੀਂ ਪਹੁੰਚੇ ਇਸ ਲਈ ਸਾਨੂੰ ਬਹੁਤ ਪਰੇਸ਼ਾਨੀ ਹੋ ਰਹੀ ਆ ਪਲੀਜ਼ ਦੱਸੇ ਪਤੇ 'ਤੇ ਜਲਦੀ ਤੋਂ ਜਲਦੀ ਪਹੁੰਚੋ ਤਾਂ ਕਿ ਅਸੀਂ ਸਮੇਂ ਸਿਰ ਦਰਸ਼ਨਾਂ ਲਈ ਜਾ ਸਕੀਏ ਪਲੀਜ਼ ਓਕੇ